ਜੀ ਹਾਂ ਮੇਰੇ ਕੋਲ ਕਈ ਮਨਪਸੰਦ ਪੰਜਾਬੀ ਕਹਾਵਤਾਂ ਹਨ ਇਹ ਕਹਾਵਤਾਂ ਜੀਵਨ ਦੇ ਵਿੱਚ ਅਖਾਣਾਂ ਅਤੇ ਅਕਸਰ ਮੁਹਾਵਰੇ ਵਰਤਦੀਆਂ ਹਨ ਜੋ ਕਿ ਮਹਿਸੂਸ ਹੁੰਦਾ ਹੈ ਕਿ ਬਹੁਤ ਹੀ ਚੰਗੀਆਂ ਹੁੰਦੀਆਂ ਹਨ ਇੱਕ ਵਰਗਾ ਕਹਾਵਤ ਹੈ ਅੱਖ ਦੇ ਰੰਗ ਅੱਖਾਂ 'ਚ ਹੀ ਆਉਂਦੇ ਹਨ ਇਸ ਨਾਲ ਇਹ ਇਸ਼ਾਰਾ ਕੀਤਾ ਜਾਂਦਾ ਹੈ ਕਿ ਸੱਚਾਈ ਦੇ ਅਕਸਰ ਪਤਾ ਲੱਗਦਾ ਹੈ ਸਿਰਫ ਆਪਣੀਆਂ ਅੱਖਾਂ ਨਾਲ ਵੀਰੇ ਦਾ ਪਿੰਡ ਜਿਹਾ ਹੋਵੇ ਦਾ ਰੰਗ ਸਾਰੇ ਹੀ ਦੇਖੇ ਜਾ ਸਕਦੇ ਹਨ ਇਸ ਤੋਂ ਸਿੱਖ ਮਿਲਦੀ ਹੈ ਕਿ ਹਰ ਕੋਈ ਇੱਕ ਜਵਾਬ ਤੱਕ ਨਹੀਂ ਰੱਖਦਾ ਇਹ ਇੱਕ ਇੱਕ ਇਹ ਵੀ ਸੁਨੇਹਾ ਹੈ ਕਿ ਖੁਦਾਈ ਦੇ ਘਰ ਦੇ ਰੰਗ ਬੋਤਾ ਦੀ ਤਰ੍ਹਾਂ ਹਨ ਜਿਸ ਨਾਲ ਸਮਝਾਇਆ ਜਾਂਦਾ ਹੈ ਕਿ ਦੇਤਾਵਾਦੀ ਵਿੱਚ ਭਗਵਾਨ ਦੇ ਅਨੁਭਵ ਦੀ ਤੁਲਨਾ ਬਹੁਤੀ ਵੀ ਤੋੜੀ ਨਹੀਂ ਹੋਵੇਗੀ ਇਸ ਤਰ੍ਹਾਂ ਇਹ ਕੁਛ ਪੰਜਾਬੀ ਕਹਾਵਤਾਂ ਹਨ ਜੋ ਮੇਰੇ ਕੋਲ ਪਸੰਦੀਦਾ ਹਨ ਅਤੇ ਜੋ ਜੀਵਨ ਦੇ ਵੀ ਵਿਦ ਹੋਰੇ ਨੂੰ ਛੂਹਣ ਦੀ ਸਮਝ ਪ੍ਰਦਾਨ ਕਰਦੀਆਂ ਹਨ ਸਾਡੇ ਕਲਚਰ ਵਿੱਚ ਪਹਿਰਾਵਾ ਅਤੇ ਇੱਕ ਵਾਤਾਵਰਨ ਪਰੇਸ਼ਾਨੀਆਂ ਬਾਰੇ ਵੀ ਇੱਕ ਕਹਾਵਤ ਹੈ ਇੱਕ ਵਾਰ ਬਜ਼ਾਰ 'ਚ ਫਿਰਦੇ ਵੇਖੋ ਫਿਰ ਨੂੰ ਗੱਲਾਂ ਕਰੋ ਜੋ ਹਮੇਸ਼ਾ ਸਿਖਾਇਆ ਜਾਂਦਾ ਹੈ ਕਿ ਪਹਿਲੇ ਗੱਲਾਂ ਨੂੰ ਸ਼ਾਂਤੀ ਨਾਲ ਹੱਲ ਕਰਨਾ ਚਾਹੀਦਾ ਹੈ ਹੋਰ ਵੀ ਜਿਵੇਂ ਮੁਹਾਵਰੇ ਹੀ ਵਰਤਦੇ ਹਾਂ ਕਿ ਜਿੱਦਾਂ ਕਰੋਗੇ ਉੱਦਾਂ ਭਰੋਗੇ ਇੱਟ ਕੁੱਤੇ ਦਾ ਵੈਰ ਹੋਣਾ ਮਤਲਬ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦੁਸ਼ਮਣੀ ਹੋਣਾ ਚਾਦਰ ਵੇਖ ਕੇ ਪੈਰ ਪਸਾਰਨਾ ਕਿ ਤੁਹਾਡੇ ਜਿੰਨੇ ਤੁਹਾਡੀ ਚਾਦਰ ਆ ਓਨੇ ਤੁਸੀਂ ਪੈਰ ਪਸਾਰੋ ਸੋ ਮੁਹਾਵਰਾ ਅਤੇ ਕਹਾਵਤਾਂ ਨਾਲ ਸਾਨੂੰ ਬਹੁਤ ਹੀ ਕਹਿ ਸਕਦੇ ਹੋ ਕਿ ਮਦਦ ਮਿਲਦੀ ਹੈ ਆਪਣੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਲੋਕਾਂ ਸਾਹਮਣੇ ਪ੍ਰਸਤੁਤ ਕਰਨ ਦੀ